ਸਾਡੇ ਰਾਜ ਦੇ ਬਹੁਤ ਹਿੱਸੇ ਅਬਾਦੀ ਵਾਲੇ ਮੈਂ ਜਿਸ ਤਰ੍ਹਾਂ ਜਲੰਧਰ ਵਿੱਚ ਰਹਿੰਦੀ ਹਾਂ ਉਹਦੇ ਵਿੱਚ ਮੈਂ ਬਸਤੀ ਸ਼ੇਖਾਂ ਬਸਤੀ ਸ਼ੇਖਾਂ ਕਹਿ ਸਕਦੀ ਹਾਂ ਮਕਸੂਦਾਂ ਕਹਿ ਸਕਦੀ ਹਾਂ ਇਹ ਥੋੜ੍ਹੇ ਨਾ ਜ਼ਿਆਦਾ ਅਬਾਦੀ ਵਾਲ਼ੇ ਹੈਗੇ ਹੈ ਹਿੱਸੇ ਅਤੇ ਭੀੜ ਭੜੱਕਾ ਹੁੰਦਾ ਜਿਸ ਤਰ੍ਹਾਂ ਸਾਡੇ ਮਾਈ ਹੀਰਾ ਗੇਟ ਹੈ ਉਨ ਮਤਲਬ ਮਿੱਠਾ ਬਜ਼ਾਰ ਹੈ ਅਸੀਂ ਉੱਥੇ ਮਤਲਬ ਅਸੀਂ ਐਤਵਾਰ ਨੂੰ ਸ਼ਨੀਵਾਰ ਨੂੰ ਅਸੀਂ ਉੱਥੇ ਲੰਘ ਨਹੀਂ ਸਕਦੇ ਇੰਨਾ ਜ਼ਿਆਦਾ ਰੱਸ਼ ਹੁੰਦਾ ਹੈ ਇੰਨਾ ਜ਼ਿਆਦਾ ਲਾਂਘਾ ਹੁੰਦਾ ਓੱਥੇ ਇੰਨੀ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਅਤੇ ਫਿਰ ਉਸ ਤੋਂ ਬਾਅਦ ਓੱਥੇ ਜਿਹਨਾਂ ਦੇ ਲੋਕਾਂ ਦੇ ਘਰ ਨੇ ਉਹ ਬਾਹਰ ਨਹੀਂ ਨਿਕਲ ਸਕਦੇ ਬਾਹਰ ਨਿਕਲਾਂਗੇ ਤਾਂ ਗੱਡੀਆਂ ਹੀ ਗੱਡੀਆਂ ਹੈ ਔਰ ਕਿੰਨੀ ਜ਼ਿਆਦਾ ਘਰ 'ਚ ਪਰੇਸ਼ਾਨੀ ਹੈ ਕਿ ਬੱਚਾ ਘਰ 'ਚ ਵੜ ਹੀ ਨਹੀਂ ਸਕਦਾ ਬਾਹਰੋਂ ਇੰਨਾ ਸ਼ੌਰ ਸ਼ਰਾਬਾ ਆਂਦਾ ਪਿਆ ਅਤੇ ਫਿਰ ਵੀ ਮਤਲਬ ਇਹ ਹੈਗਾ ਕਿ ਭੀੜ ਭੜੱਕਾ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਅਤੇ ਥੋੜ੍ਹਾ ਬਿਲਕੁਲ ਹੀ ਅਗਰ ਸ਼ਾਂਤ ਹੈਗਾ ਮਾਹੌਲ ਬਿਲਕੁਲ ਹੀ ਅਗਰ ਭੀੜ ਭੜੱਕਾ ਘੱਟ ਹੈ ਅਤੇ ਓੱਥੇ ਡਰ ਵੀ ਹੁੰਦਾ ਕਿ ਲੋਕ ਅਬਾਦੀ ਨਹੀਂ ਹੈਗੀ ਲੋਕ ਨਹੀਂ ਰਹਿੰਦੇ ਪਏ ਅਤੇ ਸਾਨੂੰ ਖਤਰਾ ਵੀ ਹੈ ਕਿ ਕੋਈ ਵੀ ਚੋਰ ਚਾਰ ਡਾਕੂ ਪੈ ਸਕਦਾ ਹੈ ਭੀੜ ਭੜੱਕੇ ਵਿੱਚ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਬਸ ਸਕਾਰਾਤਮਕ ਪਈ ਥੋੜ੍ਹਾ ਜਿਵੇਂ ਹੈਗਾ ਏ ਨਕਾਰਾਤਮਕ ਪਹਿਲੂ ਵੀ ਹੈ ਦੋਨੋਂ ਹੀ ਅਸੀਂ ਥੋੜ੍ਹਾ ਥੋੜ੍ਹਾ ਕਹਿ ਸਕਦੇ